ਹਾਂਜੀ ਮੇਰੇ ਕੋਲ ਪੰਛੀਆਂ ਨੂੰ ਅਕਰਸ਼ਿਤ ਕਰਨ ਲਈ ਬਹੁਤ ਵਧੀਆ ਬਹੁਤ ਸੁਭਾਅ ਬਹੁਤ ਵਧੀਆ ਸੁਝਾਵ ਹੈ ਜਿਹਦਾ ਜਿਸ ਜਿਵੇਂ ਕਿ ਮੈਂ ਆਪਣੇ ਵਿਹੜੇ ਦੇ ਵਿੱਚ ਘਰ ਦੇ ਵਿਹੜੇ ਦੇ ਵਿੱਚ ਬਹੁਤ ਸੋਹਣੇ ਬੂਟੇ ਬਹੁਤ ਸੋਹਣੇ ਸੋਹਣੇ ਦਰਖ਼ਤ ਲਗਾਵਾਂਗਾ ਜਿਸ ਦੇ ਕਾਰਨ ਉਹ ਉਨ੍ਹਾਂ ਉੱਤੇ ਬਹੁਤ ਸੋਹਣੇ ਸੋਹਣੇ ਫੁੱਲ ਨਿਖਰਦੇ ਹਨ ਅਤੇ ਉਹ ਉਹਨਾਂ ਨੂੰ ਦੇਖ ਕੇ ਹੀ ਅਕਰਸ਼ਿਤ ਹੋ ਜਾਂਦੇ ਹਨ ਜਿਵੇਂ ਕੁਛ ਉਹਨਾਂ ਉੱਤੇ ਕੁਝ ਫੂਟ ਬੋਲ ਫੁੱਲ ਬੂਟੇ ਲਗਾਵਾਂਗਾ ਜਿਹੜੇ ਕਿ ਫਲ ਫਰੂਟ ਦੇ ਹੁੰਦੇ ਹਨ ਜਿਵੇਂ ਅੰਬ ਦੇ ਦਰਤਖ਼ ਜਿਵੇਂ ਸੇਬ ਦੇ ਜਾਂ ਅਨਾਰ ਦੇ ਉਹਨਾਂ ਨੂੰ ਦੇਖ ਕੇ ਪੰਛੀ ਬਹੁਤ ਅਕਰਸ਼ਿਤ ਹੁੰਦੇ ਹਨ ਅਤੇ ਆਪਣੇ ਖਾਣ ਵਾਸਤੇ ਉਹਨਾਂ ਨੂੰ ਉੱਥੇ ਆਉਂਦੇ ਵੀ ਹਨ ਹਾਂ ਅਸੀਂ ਆਪਣੇ ਕੋਠੇ ਉੱਤੇ ਦੋ ਕਟੋਰੇ ਰੱਖੇ ਹੋਏ ਹਨ ਮਿੱਟੀ ਦੇ ਜਿਹਦੇ ਘਰ ਇੱਕ ਦੇ ਵਿੱਚ ਪਾਣੀ ਹੈ ਅਤੇ ਦੂਜੇ ਵਿੱਚ ਅਨਾਜ ਹੈ ਜਿਸ ਦੇ ਕਾਰਨ ਉਹ ਉਨ੍ਹਾਂ ਨੂੰ ਦੇਖ ਕੇ ਆਕਰਸ਼ਿਤ ਹੋ ਜਾਂਦੇ ਹਨ ਅਤੇ ਪਾਣੀ ਪੀਣ ਲਈ ਜਾਂ ਅਨਾਜ ਖਾਣ ਦੇ ਲਈ ਉਹ ਆ ਜਾਂਦੇ ਹਨ ਜਿਸ ਨਾਲ ਉਹ ਬੜੇ ਖੁਸ਼ ਹੁੰਦੇ ਹਨ ਅਤੇ ਉਹਨਾਂ ਦੀਆਂ ਚੀਂ ਚੀਂ ਦੀ ਆਵਾਜ਼ਾਂ ਚੈਂ ਚੈਂ ਦੀਆਂ ਆਵਾਜ਼ਾਂ ਬਹੁਤ ਹੀ ਅਕਰਸ਼ਿਤ ਕਰਦੀਆਂ ਹਨ